ਖੇਡਾਂ ਸਾਡੀ ਪੰਜਾਬ ਦੀ ਸ਼ਾਨ ਹੈ ਪੇਂਡੂ ਲੋਕ ਹੋਣ ਉਹਨਾਂ ਨੂੰ ਵੀ ਖੇਡਣ ਦਾ ਸ਼ੌਂਕ ਹੁੰਦਾ ਹੈ ਉਹ ਵੀ ਆਪਣੇ ਬੱਚਿਆਂ ਨੂੰ ਮੋਟੀਵੇਟ ਕਰਦੇ ਹਾਂ ਕਿ ਨਹੀਂ ਬੱਚਿਓ ਖੇਡੋ ਪਹਿਲੇ ਟਾਈਮ 'ਚ ਵੀ ਲੋਕ ਖੇਡਦੇ ਸੀ ਔਰ ਤੰਦਰੁਸਤ ਰਹਿੰਦੇ ਸੀ ਖੇਡ ਹਰ ਇੱਕ ਤਰ੍ਹਾਂ ਦੀ ਖੇਡ ਖੇਡੀ ਜਾਂਦੀ ਹੈ ਪਿੰਡਾਂ ਵਿੱਚ ਵੀ ਜਿਸ ਤਰ੍ਹਾਂ ਕਬੱਡੀ ਖੋ ਖੋ ਬੈਟ ਬੋਲ ਪਿੰਡਾਂ ਵਿੱਚ ਵੀ ਖੇਡਿਆ ਜਾਂਦਾ ਹੈ ਔਰ ਸ਼ਹਿਰਾਂ ਵਿੱਚ ਵੀ ਖੇਡਿਆ ਜਾਂਦਾ ਹੈ ਪੇਂਡੂ ਲੋਕ ਵੀ ਖੇਡ ਕੇ ਹੀ ਖੁਸ਼ ਹੁੰਦੇ ਹੈ ਖੇਡ ਖੇਡਾਂ ਖੇਡ ਕੇ ਸਾਨੂੰ ਤੰਦਰੁਸਤੀ ਸਰੀਰ ਵੀ ਸਾਡਾ ਤੰਦਰੁਸਤ ਰਹਿੰਦਾ ਹੈ ਔਰ ਸਾਨੂੰ ਵੀ ਅੱਛਾ ਫੀਲ ਹੁੰਦਾ ਹੈ ਜੇ ਸਾਨੂੰ ਕੋਈ ਟੈਨਸ਼ਨ ਟੂਸ਼ਨ ਵੀ ਹੋਏ ਅਸੀਂ ਖੇਡ ਖੇਡਾਂਗੇ ਤਾਂ ਸਾਨੂੰ ਆਪਣੀ ਟੈਨਸ਼ਨ ਫਰੀ ਅਸੀਂ ਹੋ ਜਾਂਦੇ ਹਾਂ ਖੇਡਣਾ ਸਰੀਰ ਵਾਸਤੇ ਬਹੁਤ ਜ਼ਰੂਰੀ ਹੈ ਖੇਡ ਕੇ ਇਨਸਾਨ ਬਹੁਤ ਖੁਸ਼ ਰਹਿੰਦਾ ਹੈ ਔਰ ਖੇਲ ਖੇਡਣਾ ਵੀ ਚਾਹੀਦਾ ਹੈਗਾ ਪੰਜਾਬ ਵਿੱਚ ਖੇਡਾਂ ਨੂੰ ਇੱਕ ਬਹੁਤ ਮਹੱਤਵ ਦਿੱਤਾ ਗਿਆ ਪੰਜਾਬ ਵਿੱਚ ਖੇਡ ਖੇਡਣਾ ਬਹੁਤ ਇੱਕ ਜ਼ਿਆਦਾ ਦੱਸਿਆ ਗਿਆ ਹੈ ਪਿੰਡ ਵਿੱਚ ਲੋਕ ਬਹੁਤ ਇੰਜੋਆਏ ਕਰਦੇ ਆ ਖੇਡਾਂ ਨੂੰ ਕੋਈ ਇਹ ਗੱਲ ਨਹੀਂ ਕਿ ਪੇਂ ਪੇਂਡੂ ਲੋਕ ਖੇਡਾਂ ਨਹੀਂ ਖੇਡਦੇ ਪੇਂਡੂ ਲੋਕ ਵੀ ਖੇਡਾਂ ਖੇਡ ਕੇ ਬਹੁਤ ਖੁਸ਼ ਹੁੰਦੇ ਆ ਉਹ ਆਪਣੇ ਬੱਚਿਆਂ ਨੂੰ ਵੀ ਕਹਿੰਦੇ ਆ ਕਿ ਖੇਡਾਂ ਖੇਡੋ ਖੇਡਣਾ ਖੇਡਣਾ ਬਹੁਤ ਜ਼ਰੂਰੀ ਹੁੰਦਾ ਖੇਡਣ ਨਾਲ ਇਨਸਾਨ ਦਾ ਦਿਮਾਗ ਵੀ ਠੀਕ ਰਹਿੰਦਾ ਸਰੀਰ ਵੀ ਠੀਕ ਰਹਿੰਦਾ ਔਰ ਇਨਸਾਨ ਤਰੋ ਤਾਜ਼ਾ ਰਹਿੰਦਾ